ਬਹੁਤ ਸਾਰੇ ਪਕਵਾਨ ਸਾਡੀ ਜ਼ਿੰਦਗੀ ਦਾ ਹਿੱਸਾ ਹਨ ਵਿਲੱਖਣ ਪਕਵਾਨ ਤਿਆਰ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਹੈ ਇਹ ਸਾਡੇ ਪਿਆਰੇ ਪੰਜਾਬ ਦਾ ਇੱਕ ਸਵਾਦਿਲਾ ਪਕਵਾਨ ਹੈ ਇਸ ਵਿੱਚ ਅਕਸਰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਦਾਲ ਚੌਲ ਰਾਜਮਾਹ ਚੌਲ ਸ਼ਾਹੀ ਪਨੀਰ ਮਟਰ ਪਨੀਰ ਆਦਿ ਸ਼ਾਮਿਲ ਹੁੰਦੀ ਹੈ ਮਟਰ ਪਨੀਰ ਬਣਾਉਣ ਵਾਸਤੇ ਸਾਨੂੰ ਜ਼ਿਆਦਾਤਰ ਸਮੱਗਰੀ ਦੀ ਲੋੜ ਪੈਂਦੀ ਹੈ ਇਸ ਸਬਜ਼ੀ ਨੂੰ ਸਵਾਦ ਬਣਾਉਣ ਲਈ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਬਜ਼ੀ ਦੀ ਚੰਗੀ ਮਹਿਕ ਵਾਸਤੇ ਅਲੱਗ ਸਮੱਗਰੀ ਦੀ ਲੋੜ ਪੈਂਦੀ ਹੈ ਜਿਵੇਂ ਕਿ ਮੇਥੀ ਧਨੀਆ ਕੜ੍ਹੀ ਪੱਤਾ ਆਦਿ ਜ਼ਿਆਦਾਤਰ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਸਰੀਰ ਦੀ ਤਾਕਤ ਵਾਸਤੇ ਸਰਦੀਆਂ ਵਿੱਚ ਪੰਜੀਰੀ ਬਣਾਈ ਜਾਂਦੀ ਹੈ ਜਿਸ ਵਿੱਚ ਨਾਰੀਅਲ ਖੰਡ ਬਦਾਮ ਦੀਆਂ ਗਿਰੀਆਂ ਕਾਜੂ ਸੌਗੀ ਫੁੱਲ ਮਖਾਣੇ ਅਤੇ ਹੋਰ ਬਹੁਤ ਸਾਰੀ ਸਮੱਗਰੀ ਦੀ ਭਰਪੂਰ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ